ਮੈਂ ਪਿੱਛੇ ਇੱਕ ਯਾਤਰਾ ਕਰਨ ਗਿਆ ਕਰਨਾਟਕ 'ਚ ਉੱਥੇ ਜਾ ਕੇ ਮੈਂ ਆਪਣੀ ਲੈਂਗੁਏਜ ਬੋਲਦਾ ਰਿਹਾ ਲੇਕਿਨ ਉੱਥੋਂ ਦੀ ਲੈਂਗੁਏਜ 'ਚ ਮੈਨੂੰ ਕਾਫੀ ਫਰਕ ਨਜ਼ਰ ਆਇਆ ਉਹ ਸਮਝਣ 'ਚ ਮੈਨੂੰ ਕਾਫੀ ਮੁਸ਼ਕਿਲ ਆਉਣ ਪਈ ਲੇਕਿਨ ਮੇਰਾ ਯਾਰ ਨਾਲ ਦਾ ਦੋਸਤ ਸੀਗਾ ਮੇਰਾ ਫਰੈਂਡ ਜਿਹਦੇ ਨਾਲ ਅਸੀਂ ਗਏ ਸੀ ਉਹਨੂੰ ਕਰਨਾਟਕ ਆਉਂਦੀ ਸੀ ਉਹ ਭਾਸ਼ਾ ਆਉਂਦੀ ਸੀ ਉਹਨੂੰ ਥੋੜ੍ਹਾ ਜਿਹਾ ਮੈਨੂੰ ਸਿੱਖਣ ਨੂੰ ਵੀ ਮਿਲਿਆ ਕਿ ਉਹਦਾ ਲੈਂਗੂਏਜ ਕਿੰਨੀ ਉਹਦੇ ਮਿਠਾਸ ਕਿੰਨੀ ਉਹ ਸਾਡੀ ਲੈਂਗੁਏਜ 'ਚ ਤਾਂ ਹੈਗੀ ਹੈਗੀ ਆ ਪੰਜਾਬੀ ਲੈਂਗੁਏਜ ਹਰ ਕਿਸੇ ਨੂੰ ਭਾਉਂਦੀ ਆ ਲੇਕਿਨ ਉਹ ਕਰਨਾਟਕ ਦੀ ਲੈਂਗੂਏਜ ਜਿਹੜੀ ਸੀਗੀ ਉਹ ਕਾਫੀ ਉਹਦੇ ਤੇ ਨਾ ਬੋਲਣ ਦੇ ਵਿੱਚ ਕੁਛ ਵਰਡ ਇਹੋ ਜਿਹੇ ਸੀਗੇ ਕਿ ਤੁਹਾਡੇ ਦਿਲ ਨੂੰ ਛੂਹਦੇ ਸੀਗੇ ਮੈਂ ਕਾਫੀ ਉੱਥੇ ਜ਼ਿਆਦਾ ਤੋਂ ਜ਼ਿਆਦਾ ਮੈਂ ਪੰਦਰਾਂ ਕੁ ਦਿਨ ਰਿਹਾ ਪੰਦਰਾਂ ਦਿਨ 'ਚ ਨਾ ਹੁਣ ਕੁਛ ਵਰਡ ਇਹੋ ਜਿਹੇ ਅੱਛੇ ਲੱਗੇ ਔਰ ਮੈਂ ਥੋੜ੍ਹੀ ਬਹੁਤੀ ਆਉਣੀ ਵੀ ਸ਼ੁਰੂ ਹੋ ਗਈ ਮੈਂ ਕਾਫੀ ਮੈਨੂੰ ਅੱਛਾ ਲੱਗਾ ਕਿ ਇੱਕ ਅਨੁਭਵ ਹੀ ਹੋਇਆ ਕਿ ਅਲੱਗ ਸ਼ਹਿਰ 'ਚ ਜਾ ਕੇ ਤੁਸੀਂ ਅਲੱਗ ਚੀਜ਼ ਸਿੱਖ ਸਕਦੇ ਹੋ